ਹੈਲੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਮੈਂ ਅਭੈਜੀਤ ਦੀ ਟੀਚਰ ਬੋਲਦੀ ਹਾਂ ਹਾਂਜੀ ਹਾਂਜੀ ਅਭੈ ਦੇ ਨਾ ਬਾਕੀ ਸਬਜੈਕਟ 'ਚੋਂ ਵਧੀਆ ਨੰਬਰ ਆਏ ਆ ਜਿੱਦਾਂ ਇੰਗਲਿਸ਼ ਵਿੱਚੋਂ ਏਟੀ 'ਚੋਂ ਸੈਵਨਟੀ ਫਾਈਵ ਆਏ ਆ ਹਿੰਦੀ ਤੋਂ ਜਿੱਦਾਂ ਏਟੀ ਵਿੱਚੋਂ ਫਿਫਟੀ ਸੈਵਨ ਆਏ ਆ ਮੈਥ 'ਚੋਂ ਏਟੀ ਵਿੱਚੋਂ ਸਿਕਸਟੀ ਸੈਵਨ ਆਏ ਹੈ ਇੰਗਲਿਸ਼ ਵਿੱਚੋਂ ਏਟੀ ਵਿੱਚੋਂ ਸੈਵਨਟੀ ਫਾਈਵ ਆਏ ਆ ਮਤਲਬ ਸਾਰੇ ਸਬਜੈਕਟ ਵਧੀਆ ਬਟ ਇਹ ਤਾਂ ਥੋੜ੍ਹਾ ਜਿਹਾ ਹਿੰਦੀ ਵਿੱਚੋਂ ਇਹ ਵੀਕ ਆ ਅਤੇ ਇਹਨੂੰ ਹਿੰਦੀ ਵਿੱਚੋਂ ਇਹਦੀ ਨਾ ਟਿਊਸ਼ਨ ਰਖਵਾ ਦਿਓ ਜਿਹੜੇ ਕਿ ਅਗਲੇ ਸਾਲ ਇਹਦੇ ਵਧੀਆ ਨੰਬਰ ਆਉਣ ਫਿਰ ਇਹਦੇ ਪੁਜੀਸ਼ਨ ਵੀ ਆ ਜੂਗੀ ਅਤੇ ਬਾਕੀ ਇਹ ਸਪੋਰਟਸ ਵਿੱਚ ਇਹ ਵਧੀਆ ਹੈਗਾ ਬਾਕੀ ਸਾਰੀਆਂ ਚੀਜ਼ਾਂ 'ਚ ਇਹ ਬਹੁਤ ਵਧੀਆ ਅਤੇ ਤੁਸੀਂ ਇਹਦੇ ਵੱਲ ਥੋੜ੍ਹਾ ਜਿਹਾ ਹੋਰ ਧਿਆਨ ਦਿਓ ਜਾਂ ਕਿ ਇਹ ਬੱਚਾ ਕੀ ਆ ਤਾਂ ਕੀ ਹੈ ਇਹ ਕਰ ਸਕੇ